ਸਾਡੇ ਰਾਜ ਵਿੱਚ ਬਹੁਤ ਹੀ ਸਾਰੀਆਂ ਮਤਲਬ ਭਾਸ਼ਾਵਾਂ ਹਨ ਜਿਵੇਂ ਕਿ ਪੰਜਾਬੀ ਹਿੰਦੀ ਇੰਗਲਿਸ਼ ਫਰੈਂਚ ਅਤੇ ਔਰ ਅਤੇ ਆਪਾਂ ਮਤਲਬ ਕਿ ਆਪਾਂ ਨੂੰ ਕਿਸੇ ਵੀ ਭਾਸ਼ਾ ਨੂੰ ਮਤਲਬ ਨੀ ਨੀਚਾ ਨਹੀਂ ਦਿਖਾਉਣਾ ਚਾਹੀਦਾ ਸਾਰੀਆਂ ਭਾਸ਼ਾਵਾਂ ਇਕੁਅਲ ਹੁੰਦੀਆਂ ਹੈ ਜਿਵੇਂ ਕਿ ਜਿਹੜੀ ਭਾਸ਼ਾ ਹੁੰਦੀ ਆ ਉਹ ਇੱਕ ਸਿਰਫ ਜ਼ਰੀਆ ਹੁੰਦਾ ਏ ਆਪਣੀ ਗੱਲ ਅਗਲੇ ਬੰਦੇ ਨੂੰ ਸਮਝਾਉਣ ਦੀ ਜਿਵੇਂ ਅਗਰ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਅਗਲਾ ਇੰਗਲਿਸ਼ ਇਹਦੇ ਨਾਲ ਆਪਾਂ ਨੂੰ ਇੰਗਲਿਸ਼ ਸਿੱਖਣੀ ਪੈਂਦੀ ਹੈ ਉਸ ਬੰਦੇ ਨੂੰ ਉਸ ਓਸ ਚੀਜ਼ ਬਾਰੇ ਸਮਝਾਉਣ ਬਾਰੇ ਮਤਲਬ ਕਿ ਸਾਰਾ ਇੱਕ ਮੋਟਿਵ ਇਹ ਆ ਕਿ ਆਪਾਂ ਨੂੰ ਕਦੇ ਵੀ ਆਪਣੀ ਜਿਹੜੀ ਭਾਸ਼ਾ ਏ ਉਹਨੂੰ ਮਤਲਬ ਕਿ ਪਛਾੜਨਾ ਨਹੀਂ ਚਾਹੀਦਾ ਜਿਵੇਂ ਕਿ ਅੱਜ ਕੱਲ੍ਹ ਦੇ ਲੋਕ ਹੁੰਦੇ ਆ ਉਹ ਪੰਜਾਬੀ ਨੂੰ ਮਤਲਬ ਕਿ ਇੱਕ ਸ਼ਰਮ ਮਹਿਸੂਸ ਕਰਦੇ ਆ ਉਹਨਾਂ ਨੂੰ ਲੱਗਦਾ ਵਾ ਕਿ ਪੰਜਾਬੀ ਭਾਸ਼ਾ ਮਤਲਬ ਵਧੀਆ ਨਹੀਂ ਹੈਗੀ ਅਤੇ ਉਹ ਆਪਣੇ ਆਪ ਨੂੰ ਵਧੀਆ ਕਰਨ ਲਈ ਇੰਗਲਿਸ਼ ਸਿੱਖਦੇ ਆ ਪੰਜਾਬੀ ਸਿੱਖਦੇ ਆ ਹਾਂ ਆਪਾਂ ਨੂੰ ਇੰਗਲਿਸ਼ ਪੰਜਾਬੀ ਹਿੰਦੀ ਸਿੱਖਣੀ ਚਾਹੀਦੀ ਹੈ ਕਿਉਂਕਿ ਹਿੰਦੀ ਵੀ ਆਪਣੀ ਮਾਤ ਭਾਸ਼ਾ ਹੈਗੀ ਆ ਆਪਾਂ ਨੂੰ ਅਗਰ ਹਿੰਦੀ ਨਹੀਂ ਆਵੇਗੀ ਇੰਗਲਿਸ਼ ਨਹੀਂ ਆਵੇਗੀ ਤਾਂ ਆਪਾਂ ਆਪਣੇ ਆਪ ਨੂੰ ਅੱਗੇ ਜਾ ਕੇ ਮਤਲਬ ਐਕਸਪਲੇਨ ਨਹੀਂ ਕਰ ਸਕਦੇ ਅੱਗੇ ਜਾ ਕੇ ਆਪਾਂ ਮਤਲਬ ਕਿਸੇ ਨਾਲ ਵੀ ਆਪਾਂ ਗੱਲ ਕਰ ਸਕਦੇ ਉਤੇਜਿਤ ਕਰ ਸਕਦੇ ਹਾਂ ਕਿਸੇ ਨੂੰ ਵੀ ਪੰਜਾਬੀ ਭਾਸ਼ਾ ਵੀ ਇੱਕ ਬਹੁਤ ਹੀ ਵਧੀਆ ਮਤਲਬ ਮਿਸਾਲ ਹੈਗੀ ਆ ਜਿਵੇਂ ਸਾਡੇ ਅੱਜ ਕੱਲ੍ਹ ਦੇ ਸਿੰਗਰਜ਼ ਹੋ ਗਏ ਪੰਜਾਬੀ ਸਿੰਗਰ ਹੈਗੇ ਆ ਸਿੱਧੂ ਮੂਸੇਵਾਲਾ ਦਿਲਜੀਤ ਦੁਸਾਂਝ ਉਹਨਾਂ ਨੇ ਵੀ ਪੰਜਾਬੀ ਭਾਸ਼ਾ ਨੂੰ ਬੜੀ ਜ਼ਿਆਦਾ ਪ੍ਰੈਫਰੈਂਸ ਦਿੱਤੀ ਹੋਈ ਆ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਬੜੀ ਹੀ ਜ਼ਿਆਦਾ ਪ੍ਰਸਿੱਧ ਕਰ ਦਿੱਤਾ ਹੋਇਆ ਹੈ ਕਿ ਜਿਵੇਂ ਲੋਕ ਹੈ ਬਾਹਰ ਦੇ ਲੋਕ ਹੈ ਉਹ ਵੀ ਮਤਲਬ ਕਿ ਇੱਥੇ ਆਪਣੇ ਪੰਜਾਬੀ ਸਿੱਖਦੇ ਆ ਸ ਕਈ ਜਿਹੜੇ ਇਹੋ ਜਿਹੇ ਪੰਜਾਬੀ ਲੋਕ ਆ ਜਿਹੜੇ ਮਤਲਬ ਬਾਹਰ ਜਾ ਕੇ ਵੀ ਗੋਰਿਆਂ ਨੂੰ ਮਤਲਬ ਪੰਜਾਬੀ ਬੋਲਣ ਲਗਾ ਦਿੰਦੇ ਆ ਜਿਹੜੇ ਗੋਰੇ ਹੁੰਦੇ ਆ ਉਹ ਆਪਣੇ ਆਪ ਨੂੰ ਮਤਲਬ ਕਿ ਇੱਕ ਇਹੋ ਜਿਹਾ ਬਣਾ ਲੈਂਦੇ ਆ ਕਿ ਉਹ ਉਹਨਾਂ ਨੂੰ ਪੰਜਾਬੀ ਸਿੱਖਣ ਲਈ ਆਪਣੇ ਪੰਜਾਬ ਵਿੱਚ ਆਉਂਦੇ ਆ ਪੰਜਾਬ ਇੱਕ ਪੰਜਾਬੀ ਭਾਸ਼ਾ ਆਪਣੇ ਆਪਣੇ ਪੰਜਾਬੀ ਭਾਸ਼ਾ ਆਪਣੇ ਆਪ ਲਈ ਮਤਲਬ ਬੜੀ ਹੀ ਵਧੀਆ ਇੱਕ ਮਤਲਬ ਮਿਸਾਲ ਹੈਗੀ ਆ ਆਪਾਂ ਨੂੰ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਬੇਝਿਜਕ ਹੋ ਕੇ ਅਗਰ ਤੁਹਾਨੂੰ ਪੰਜਾਬੀ ਆਉਂਦੀ ਆ ਕੋਈ ਵੀ ਭਾਸ਼ਾ ਸਿੱਖੋ ਪਰ ਪੰਜਾਬੀ ਨੂੰ ਵੀ ਮੇਨ ਰੱਖੋ ਕਿਉਂਕਿ ਉਹ ਤੁਹਾਡੀ ਇੱਕ ਬਹੁਤ ਹੀ ਮਾਂ ਭਾਸ਼ਾ ਹੈਗੀ ਆ ਜਿਹਦੇ ਨਾਲ ਤੁਸੀਂ ਮਤਲਬ ਕਿ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕਦੇ ਹੋ